ਪੰਜਾਬੀ ਭਾਸ਼ਾ ਇੱਕ ਮਿੱਠੀ ਅਤੇ ਸਰਲ ਭਾਸ਼ਾ ਹੈ ਪਹਿਲੋਂ ਆਪਾਂ ਪੰਜਾਬੀ ਬੜੇ ਸ਼ੁੱਧ ਲੋਕ ਕੋਈ ਨਾ ਕੋਈ ਇੰਗਲਿਸ਼ ਨਾ ਕਿਸੇ ਹੋਰ ਲੈਂਗ ਭਾਸ਼ਾ ਦਾ ਕੋਈ ਆਪਾਂ ਵ ਅੱਖਰ ਨਹੀਂ ਯੂਜ ਕਰਦੇ ਸੀ ਪਰ ਹੁਣ ਸਾਡੇ ਨੌਜਵਾਨਾਂ ਨੂੰ ਕੁਝ ਦਹਾਕੇ ਦੇ ਅੰਦਰ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਆ ਪੜ੍ਹਾਈਆਂ ਕਰਨ ਆਪਣਾ ਬਿਜਨਸ ਸੈਟ ਕਰਨ ਦੇ ਉਹਨਾਂ ਨੇ ਉਹਨਾਂ ਨੂੰ ਆਈਲੈਟਸ ਕੋਰਸ ਕਰਨੇ ਪੈਂਦੇ ਹਨ ਜੋ ਕਿ ਜਿਹਨਾਂ ਨੂੰ ਜਿਹਨਾਂ ਕਰਨ ਲਈ ਦਾ ਪ੍ਰਯੋਗ ਜ਼ਰੂਰੀ ਹੋ ਗਿਆ ਇੰਗਲਿਸ਼ ਵਿੱਚ ਇੱਕ ਮਹਾਰਤ ਹਾਸਲ ਕਰਨਾ ਜ਼ਰੂਰੀ ਹੋ ਗਿਆ ਹੈ ਜਿਸ ਕਾਰਨ ਸਾਡੇ ਪ ਨੌਜਵਾਨਾਂ ਦੇ ਪੰਜਾਬੀ ਭਾਸ਼ਾ ਦੇ ਪ੍ਰਤੀ ਰੁਝਾਨ ਘੱਟ ਗਿਆ ਹੈ ਅਤੇ ਪੰਜਾਬੀ ਦੇ ਭਸ਼ ਭਾਸ਼ਾ ਦੇ ਵਿੱਚ ਜ਼ਿਆਦਾਤਰ ਇੰਗਲਿਸ਼ ਦੇ ਲਫ ਅੱਖਰਾਂ ਦੀ ਵਰਤੋਂ ਹੋ ਗਈ ਹੈ